ਸਤਿ ਸ਼੍ਰੀ ਅਕਾਲ ਜੀ ਪਿਛਲੇ ਦਿਨੀਂ ਮੈਂ ਇੱਕ ਕਿਤਾਬ ਔਡਰ ਉੱਤੇ ਮੰਗਵਾਈ ਸੀ ਜੋ ਕਿ ਅੱਠ ਦਿਨ ਬੀਤ ਜਾਣ ਤੋਂ ਬਾਅਦ ਵੀ ਮੇਰੇ ਕੋਲ ਹਾਲੇ ਤੱਕ ਨਹੀਂ ਪੁੱਜੀ ਮੈਂ ਤੁਹਾਡੇ ਕੋਲੋਂ ਇਹ ਜਾਣਨਾ ਚਾਹੁੰਦਾ ਹਾਂ ਕਿ ਮੇਰੀ ਕਿਤਾਬ ਮੇਰੇ ਕੋਲ ਕਿਉਂ ਨਹੀਂ ਪਹੁੰਚੀ ਜਦੋਂ ਮੈਂ ਵੈਬਸਾਈਟ ਉੱਤੇ ਉਸਦੀ ਦੇਖਦਾ ਹਾਂ ਤਾਂ ਉਹ ਡਿਲੀਵਰ ਹੋ ਗਈ ਦਿਖਾਉਂਦੀ ਹੈ ਜਦੋਂ ਕਿ ਕਿਤਾਬ ਮੇਰੇ ਕੋਲ ਹਾਲੇ ਤੱਕ ਨਹੀਂ ਪੁੱਜੀ ਕਿਰਪਾ ਕਰਕੇ ਤੁਸੀਂ ਇਸ ਚੀਜ਼ ਦੀ ਜਾਂਚ ਕਰੋ ਅਤੇ ਮੈਨੂੰ ਜਲਦੀ ਤੋਂ ਜਲਦੀ ਇਸ ਸੰਬੰਧੀ ਜਾਣਕਾਰੀ ਪਹੁੰਚਦੀ ਕਰੋ ਤਾਂ ਜੋ ਮੇਰਾ ਔਰਡਰ ਕੀਤਾ ਗਿਆ ਸਮਾਨ ਮੇਰੇ ਤੱਕ ਸਮੇਂ ਸਿਰ ਪੁੱਜ ਸਕੇ ਧੰਨਵਾਦ ਜੀ